ਜਦੋਂ ਦਾ ਮੈਂ ਯੋਗਾ ਕਰਨਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲੀ ਚੀਜ਼ ਜੋ ਮੈਂ ਮਹਿਸੂਸ ਕੀਤੀ ਉਹ ਮੇਰੇ ਸਰੀਰ ਦੀ ਵਧਦੀ ਹੋਈ ਲਚਕਤਾ ਸੀ ਸ਼ੁਰੂਆਤ ਵਿੱਚ ਸਧਾਰਨ ਖਿੱਚਾਂ ਵੀ ਔਖੀਆਂ ਲੱਗਦੀਆਂ ਸਨ ਪਰ ਸਮੇਂ ਦੇ ਨਾਲ ਮੇਰੀਆਂ ਪੇਸ਼ੀਆਂ ਢਿੱਲੀਆਂ ਹੋਣ ਲੱਗੀਆਂ ਅਤੇ ਮੈਂ ਹੋਰ ਆਸਾਨੀ ਨਾਲ ਹਿੱਲਣ ਜੁੱਲਣ ਲੱਗੀ ਮੇਰੀ ਮੌਲਿਕਤਾ ਵੀ ਬਿਹਤਰ ਹੋ ਗਈ ਜਿਸ ਨਾਲ ਮੈਂ ਆਪਣੇ ਸਰੀਰ ਵਿੱਚ ਹੋਰ ਵਿਸ਼ਵਾਸੀ ਅਤੇ ਆਰਮਦਾਇਕ ਮਹਿਸੂਸ ਕੀਤਾ ਲਚਕਤਾ ਦੇ ਨਾਲ ਨਾਲ ਮੇਰੀ ਤਾਕਤ ਵੀ ਵਧਦੀ ਗਈ ਖਾਸ ਤੌਰ 'ਤੇ ਮੇਰੀ ਕੋਰ ਅਤੇ ਟੰਗਾਂ ਵਿੱਚ ਕਿਉਂਕਿ ਵੱਖ ਵੱਖ ਆਸਣ ਧਾਰਨ ਕਰਨ ਨਾਲ ਸੰਤੁਲਨ ਅਤੇ ਸਥਿਰਤਾ ਦੀ ਲੋੜ ਪੈਂਦੀ ਹੈ ਯੋਗਾ ਨੇ ਮੈਨੂੰ ਮੇਰੇ ਸਰੀਰ ਅਤੇ ਇਸ ਸਰਚਨਾ ਬਾਰੇ ਹੋਰ ਜਾਗਰੂਕ ਬਣਾਇਆ ਜਿਸ ਨਾਲ ਮੇਰੇ ਪਿੱਠ ਅਤੇ ਮੋਢਿਆਂ 'ਤੇ ਪੈਣ ਵਾਲੇ ਇਹ ਤਣਾਅ ਘੱਟ ਹੋ ਗਿਆ ਸਰੀਰਿਕ ਤਬਦੀਲੀਆਂ ਤੋਂ ਇਲਾਵਾ ਯੋਗਾ ਨੇ ਮੇਰੇ ਮਾਨਸਿਕ ਸਿਹਤ ਅਤੇ ਡੂੰਘਾ ਪ੍ਰਭਾਵ ਕੇ ਪਾਇਆ ਸਾਹ ਲੈਣ ਦੀਆਂ ਕਿਰਿਆਵਾਂ ਅਤੇ ਧਿਆਨ ਨੇ ਮੈਨੂੰ ਹੋਰ ਸ਼ਾਂਤ ਅਤੇ ਕੇਂਦਰਿਤ ਮਹਿਸੂਸ ਕਰਾਇਆ ਜਿਸ ਨਾਲ ਤਣਾਅ ਅਤੇ ਚਿੰਤਾ ਘੱਟ ਹੋ ਗਈ ਮੈਂ ਪੂਰੇ ਦਿਨ ਵਧੇਰੇ ਉਜਾ ਊਰਜਾਵਾਨ ਮਹਿਸੂਸ ਕਰਨ ਲੱਗੀ ਅਤੇ ਮੇਰੀ ਨੀਂਦ ਵੀ ਕਾਫੀ ਸੁਧਰ ਗਈ ਕੁਛ ਆਸਣਾਂ ਦੇ ਹਜਮ ਪ੍ਰਣਾਲੀ ਵਿੱਚ ਵੀ ਮਦਦ ਕੀਤੀ ਜਿਸ ਨਾਲ ਫੂਲਨ ਅਤੇ ਅਸਹਿਜਤਾ ਘੱਟ ਹੋਈ ਸਮੇਂ ਦੇ ਨਾਲ ਯੋਗਾ ਮੇਰੇ ਲਈ ਸਿਰਫ ਇੱਕ ਵਰਜਿਸ਼ ਨਾ ਰਹੀ ਕਿ ਮੇਰੇ ਸਰੀਰ ਅਤੇ ਮਨ ਨਾਲ ਜੁੜਕਰ ਇੱਕ ਢੰਗ ਬਣਾਇਆ ਜਿਸ ਨੇ ਮੇਰੀ ਰੋਜ਼ਾਨਾ ਜ਼ਿੰਦਗੀ ਵਿੱਚ ਸੰਤੁਲਨ ਅਤੇ ਸ਼ਾਂਤੀ ਪੈਦਾ ਕਰ ਦਿੱਤੀ